ਮੌਸਮ ਤਾਂ ਆਪਣੀ ਜਗ੍ਹਾ ਸਾਰੇ ਹੀ ਚਲੋ ਠੀਕ ਹਨ ਲੇਕਿਨ ਮੇਰਾ ਮਨ ਭਾਉਂਦਾ ਮੌਸਮ ਠੰਡਾਂ ਦਾ ਹੈ ਸਰਦੀਆਂ ਦਾ ਮੌਸਮ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਕਿਉਂਕਿ ਸਰਦੀਆਂ ਦੇ ਮੌਸਮ ਵਿੱਚ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਮਿਲ ਜਾਂਦੀ ਹੈ ਔਰ ਸਰਦੀਆਂ ਦਾ ਠੰਡਾ ਮੌਸਮ ਕਿਤੇ ਘੁੰਮਣ ਫਿਰਨ ਅਸੀਂ ਜਾਣਾ ਹੋਵੇ ਔਰ ਖਾਣ ਪੀਣ ਦਾ ਘਰਾਂ ਖਾਣ ਪੀਣ ਦਾ ਅਨੰਦ ਬਹੁਤ ਆਉਂਦਾ ਜੀ ਘਰ ਦੀਆਂ ਪਿੰਨੀਆਂ ਗਜਰੇਲੇ ਬਹੁਤ ਵਧੀਆ ਬਣਦੇ ਨੇ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਸਰਦੀਆਂ ਵਿੱਚ ਖਾਣ ਪੀਣ ਦਾ ਅਨੰਦ ਬਹੁਤ ਆਉਂਦਾ ਜੀ ਔਰ ਘੁੰਮਣ ਵਿੱਚ ਮੈਨੂੰ ਅਨੰਦ ਇਹ ਚੀਜ਼ ਦਾ ਕਿ ਘੁੰਮਣ ਵਿੱਚ ਕੁੱਲੂ ਮਨਾਲੀ ਰੋਹਤਾਂਗ ਵਗੈਰਾ ਜਾਣ ਦਾ ਬਰਫਬਾਰੀ ਦੇਖਣ ਦਾ ਬਹੁਤ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਜੀ ਔਰ ਸਰਦੀਆਂ 'ਚ ਮੈਂ ਘੁੰਮਦਾ ਬਹੁਤ ਹਾਂ ਜੀ ਕੁੱਲੂ ਮਨਾਲੀ ਜਾਓ ਰੋਹਤਾਂਗ ਮਨਾਲੀ ਬਰਫਬਾਰੀ ਦੇਖਣੀ ਇਸ ਕਰਕੇ ਬਹੁਤ ਹੀ ਵਧੀਆ ਮੌਸਮ ਮੈਨੂੰ ਸਰਦੀਆਂ ਦਾ ਲੱਗਦਾ ਹੈ ਜੀ ਕੱਪੜੇ ਵ ਕੱਪੜੇ ਵਗੈਰਾ ਵਧੀਆ ਪੈ ਜਾਂਦੇ ਜੀ ਕੱਪੜੇ ਪਾਉਣ ਦਾ ਬਹੁਤ ਅਨੰਦ ਆਉਂਦਾ ਜੀ ਕੱਪੜੇ ਚੰਗੇ ਲੱਗਦੇ ਪਾਏ ਹੋਏ ਇਸ ਕਰਕੇ ਸਰਦੀਆਂ ਦਾ ਮੌਸਮ ਬਹੁਤ ਪਸੰਦ ਹੈ ਜੀ ਇਹਦੇ ਨਾਲ ਨਾਲ ਬਸੰਤ ਦਾ ਮੌਸਮ ਵੀ ਵਧੀਆ ਲੱਗਦਾ ਜੀ ਬਸੰਤ ਵਿੱਚ ਫੁੱਲ ਨਾਲੇ ਖਿਲ ਜਾਂਦੇ ਹੈ ਜੀ ਔਰ ਖਿੜਵੇਂ ਫੁੱਲ ਬਹੁਤ ਹੀ ਸੋਹਣੇ ਲੱਗਦੇ ਮਨਮੋਹਕ ਦ੍ਰਿਸ਼ ਬਣਦਾ ਹੈ ਇਸ ਕਰਕੇ ਮੈਨੂੰ ਸਰਦੀਆਂ ਦਾ ਮੌਸਮ ਬਹੁਤ ਜ਼ਿਆਦਾ ਪਸੰਦ ਹੈ ਕਿਉਂਕਿ ਸਰਦੀਆਂ ਵਿੱਚ ਸਾਡਾ ਸਰੀਰ ਵੀ ਜ਼ਿਆਦਾ ਵਧੀਆ ਫਿੱਟ ਰਹਿੰਦਾ ਹੈ ਚੰਗਾ